ਪਸੰਦੀਦਾ ਕਹਾਵਤਾਂ ਮੇਰੀਆਂ ਜਿਵੇਂ ਕਿ ਘਰ ਦਾ ਜੋਗੀ ਜੋਗੜਾ ਅਤੇ ਦੂਜੀ ਹੈਗੀ ਰਾਖੀਏ ਤਾਂ ਪ੍ਰੀਤ ਨਾ ਹੀ ਇਹ ਪਲੀਤ ਫਿਰ ਹੋ ਗਈ ਬਈ ਹਰ ਸੂਫ਼ੀ ਸਾਫ਼ੀ ਨਹੀਂ ਹੁੰਦਾ ਇਹ ਤਾਂ ਹੋ ਗਈ ਕੁਛ ਕਹਾਵਤਾਂ ਤਾਂ ਫਿਰ ਹੁਣ ਆ ਗਏ ਮੁਹਾਵਰੇ ਕੁਛ ਪ੍ਰਸਿੱਧ ਪਹਿਲਾ ਹੈਗਾ ਬਈ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਅਤੇ ਦੂਜਾ ਹੈਗਾ ਖਾਣੇ ਛੋਲੇ ਡਕਾਰ ਬਦਾਮਾਂ ਦੇ ਤੀਜੇ ਹੈਗੇ ਹੈ ਨ੍ਹਾਤੀ ਧੋਤੀ ਰਹਿ ਗਈ ਮੂੰਹ 'ਤੇ ਮੱਖੀ ਬਹਿ ਗਈ